ਮੈਂ ਪੰਦਰਾਂ ਵੀਹ ਦਿਨ ਪਹਿਲਾਂ ਔਨਲਾਈਨ ਐਪ ਫਲਿਪਕਾਰਡ ਤੋਂ ਇੱਕ ਸ਼ੂਜ਼ ਦਾ ਓਰਡਰ ਕੀਤਾ ਜੋ ਕਿ ਟਰੇਸਰ ਬ੍ਰੈਂਡ ਦੇ ਸੀ ਉਹ ਬੂਟ ਜਦੋਂ ਘਰ ਆਏ ਅਤੇ ਮੈਂ ਉਹਨਾਂ ਨੂੰ ਪਾ ਕੇ ਦੇਖਿਆ ਤਾਂ ਮੈਨੂੰ ਬਹੁਤ ਹੀ ਵਧੀਆ ਲੱਗਿਆ ਉਹ ਚੱਲਣ ਦੇ ਵਿੱਚ ਬੜੇ ਹੀ ਵਧੀਆ ਸੀ ਸਮੂਥ ਬਹੁਤ ਸੀ ਕੰਫਰਟ ਬਹੁਤ ਹੈ ਥੱਲੋਂ ਸਲਿੱਪ ਹੋਣ ਦਾ ਕੋਈ ਖਤਰਾ ਨਹੀਂ ਲੱਗਦਾ ਉਹਨਾਂ ਨੂੰ ਪਾ ਕੇ ਪੈਰ ਇੱਕਦਮ ਆਰਾਮਦਾਇਕ ਮਹਿਸੂਸ ਹੁੰਦਾ ਹੈ

ਜਿਸ ਲਈ ਮੈਨੂੰ ਜਿਹੜੇ ਬੂਟ ਨੇ ਬਹੁਤ ਹੀ ਵਧੀਆ ਚਾਹੀਦੇ ਹੁੰਦੇ ਨੇ ਇਹ ਬੂਟ ਜੋ ਮੈਂ ਟਰੇਸਰ ਕੰਪਨੀ ਦੇ ਮੰਗਵਾਏ ਨੇ ਇਹਨਾਂ ਦੇ ਵਿੱਚ ਉਹ ਸਾਰੀ ਖੂਬੀ ਹੈ ਇਹ ਬੂਟ ਪਾ ਕੇ ਮੇਰੇ ਪੈਰ ਨਾ ਲੱਗਾ ਕਿਤੇ ਨਾ ਮੈਨੂੰ ਕੋਈ ਦਰਦ ਮਹਿਸੂਸ ਹੁੰਦੀ ਹੈ ਮੈਂ ਸਾਰਾ ਦਿਨ ਪਾ ਕੇ ਇਹਨੂੰ ਬੜਾ ਹੀ ਕੰਫਰਟੇਬਲ ਮਹਿਸੂਸ ਕਰਦਾ ਹਾਂ ਚੱਲਣ ਫਿਰਨ ਅਤੇ ਉੱਤੇ ਥੱਲੇ ਹੋਣ 'ਚ ਮੈਨੂੰ ਕੋਈ ਦਿੱਕਤ ਨਹੀਂ ਆ ਰਹੀ ਇਹ ਬਹੁਤ ਹੀ ਵਧੀਆ ਬੂਟ ਬਣਾਇਆ ਗਿਆ ਹੈ ਕੰਪਨੀ ਦਾ ਮੈਂ ਧੰਨਵਾਦ ਕਰਦਾ ਹਾਂ